ਮੈਂ ਪਟਿਆਲਾ ਸੂਟ ਸੈਮੀ ਪਟਿਆਲਾ ਪਲਾਜੋ ਸੂਟ ਪੈਂਟ ਪਲਾਜੋ ਫਰੋਕ ਸੂਟ ਫਰੋਕਾਂ ਵੀ ਬਣਾਈਆਂ ਔਰ ਕੋਟ ਸੈਟ ਬਣਾਏ ਆ ਮੈਂ ਪਟਿਆਲਾ ਸਲਵਾਰ ਬਹੁਤ ਵਧੀਆ ਬਣਾਈ ਸੀ ਸੈਮੀ ਪਟਿਆਲਾ ਵੀ ਮੈਂ ਬਣਾਈ ਹੈ ਇੱਕ ਮੈਂ ਕੋਟ ਸੈਟ ਬਣਾਇਆ ਸੀ ਫਰਿਲ ਵਾਲੀ ਬਾਜੂ ਬਣਾਈ ਸੀ ਔਰ ਕੋਲਰ ਬਣਾਇਆ ਸੀ ਨਾਲ ਇੱਕ ਮੈਂ ਪਟਿਆਲਾ ਸਲਵਾਰ ਬਣਾਈ ਸੀ ਲੈਸ ਲਗਾ ਕੇ ਔਰ ਛੋਟੀ ਕਮੀਜ਼ ਬਣਾਈ ਸੀਗੀ ਹਾਫ ਬਾਜੂ ਬਣਾ ਕੇ ਉਹ ਵੀ ਬਹੁਤ ਵਧੀਆ ਬਣੀ ਸੀ ਮੈਂ ਬੱਚਿਆਂ ਦੀ ਨਿੱਕਰ ਸੂਟ ਵੀ ਬਣਾ ਲੈਂਂਦੀ ਹਾਂ ਔਰ ਕੁੜਤਾ ਪਜਾਮਾ ਜੈਨਸ ਦੇ ਬੱਚਿਆਂ ਦੇ ਵੋਹ ਵੀ ਬਣਾ ਲੈਂਦੀ ਹਾਂ ਵੈਨ ਗਲੇ ਵਾਲੇ ਕਮੀਜ਼ਾਂ ਉਹ ਵੀ ਤਿਆਰ ਕਰ ਲੈਂਦੀ ਹਾਂ ਔਰ ਇੱਕ ਮੈਂ ਕੋਟ ਸੈਟ ਬਣਾਇਆ ਸੀ ਉਹ ਮੈਂ ਬਹੁਤ ਵਧੀਆ ਬਣਾਇਆ ਸੀ ਕੋਲਰ ਲਗਾ ਕੇ ਪੈਂਟ ਪਲਾਜ਼ੋ ਪੈਂਟ ਪਲਾਜੋ ਬਣਾਇਆ ਸੀ ਔਰ ਧੰਨਵਾਦ